ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵੀਰੇ ਪਛਾਣ ਲਿਆ ਜੀ ਤੁਹਾਡਾ ਨੰਬਰ ਹੈਗਾ ਜੀ ਮੇਰੇ ਪਾਸ ਸੇਵ ਕਰਿਆ ਵਾ ਵਧੀਆ ਜੀ ਵਧੀਆ ਵੀਰੇ ਤੁਸੀਂ ਸੁਣਾਓ ਕਿੱਦਾਂ ਘਰ ਬਾਰ ਠੀਕ ਹੈ ਜੀ ਕੋਈ ਚੱਕਰ ਆਪਾਂ ਕਰ ਦਿੰਦੇ ਹਾਂ ਡਨ ਤੁਸੀਂ ਮੈਨੂੰ ਦੱਸੋ ਵੀ ਆਪਣਾ ਫ਼ਰਮ ਕਾਹਦੀ ਕਾਹਦੇ ਰੀਲੇਟਿਡ ਹੈ ਜੀ ਅਤੇ ਤੁਸੀਂ ਕਿਵੇਂ ਦਾ ਲੋਗੋ ਚਾਹੁੰਦੇ ਹੋ ਅਤੇ ਕਦ ਤੱਕ ਤੁਹਾਨੂੰ ਡਨ ਕਰਕੇ ਦੇਈਏ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਜੀ ਆਪਾਂ ਐਡਵਾਂਸ ਹੀ ਕੰਮ ਕਰਦੇ ਹਾਂ ਜੀ ਉਹ ਤੁਸੀਂ ਬੇਫ਼ਿਕਰ ਹੋ ਜਾਉ ਜਮ੍ਹਾਂ ਹੀ ਆਪਾਂ ਐਨ ਵਧੀਆ ਕਰਕੇ ਦੇਵਾਂਗੇ ਤੁਹਾਡੀ ਫ਼ਰਮ ਹੈ ਕਾਹਦੀ ਮਤਲਬ ਕੰਸਟ੍ਰਕਸ਼ਨ ਦੇ ਰਿਗਾਰਡਿੰਗ ਹੈ ਜੀ ਅੱਛਾ ਬਿਲਡਰ ਓਕੇ ਜੀ ਠੀਕ ਠੀਕ ਹੈ ਜੀ ਠੀਕ ਠੀਕ ਹੈ ਤੁਸੀਂ ਬੇਫ਼ਿਕਰ ਹੋ ਜਾਉ ਜੀ ਕੋਈ ਚੱਕਰ ਨਹੀਂ ਆਪਾਂ ਐਨ ਜਮਾਂ ਬੈਸਟ ਠੀਕ ਠੀਕ ਠੀਕ ਹੈ ਵੀਰੇ ਠੀਕ ਹੈ ਤੁਸੀਂ ਬੇਫ਼ਿਕਰ ਹੋ ਜਾਉ ਤੁਹਾਡਾ ਬਣਾ ਦਿੰਦਾ ਮੈਂ ਤੁਹਾਨੂੰ ਦੋ ਤਿੰਨ ਡੈਮੋ ਰੇਡੀ ਕਰ ਕੇ ਭੇਜ ਦਿੰਦਾ ਕੋਈ ਨਾ ਜੀ ਜੋ ਵੀ ਆਪਣਾ ਬੈਸਟ ਹੋਇਆ ਕੋਈ ਚੱਕਰ ਨਹੀਂ ਆਪਾਂ ਉਹ ਤੁਹਾਨੂੰ ਬੈਸਟ ਪ੍ਰਾਈਜ਼ ਦੇਵਾਂਗੇ ਜੀ ਉਹ ਤੁਸੀਂ ਬੇਫ਼ਿਕਰ ਹੋ ਜਾਉ ਤੁਸੀਂ ਔਫ਼ਿਸ ਆਓ ਆਪਾਂ ਬੈਠ ਕੇ ਡਿਸਕਸ ਕਰਦੇ ਹਾਂ ਜੀ ਤੁਸੀਂ ਮੇਰਾ ਪਹੁੰਚ ਜਾਉ ਅੱਠ ਕੁ ਵੱਜਦੇ ਨੂੰ ਕੱਲ੍ਹ ਨੂੰ ਫੇਰ ਆਪਾਂ ਮਿਲਦੇ ਠੀਕ ਹੈ ਠੀਕ ਠੀਕ ਹੈ ਸਤਿ ਸ਼੍ਰੀ ਅਕਾਲ ਜੀ